ਸਾਡੇ ਸਮਾਜ ਵਿੱਚ ਕਲਾ ਨੂੰ ਜਿਊਦਿਆਂ ਰੱਖਣ ਲਈ ਕਲਾਕਾਰ ਬਹੁਤ ਕਾਰਜਸ਼ੀਲ ਦਿਖਾਈ ਦਿੰਦੇ ਹਨ ਕਲਾਕਾਰ ਚਾਹੇ ਉਹ ਕਿਸੇ ਵੀ ਕਲਾ ਨਾਲ ਸੰਬੰਧ ਰੱਖਦਾ ਹੋਵੇ ਉਹ ਆਪਣੀ ਕਲਾ ਨੂੰ ਜਿਉਂਦਿਆਂ ਰੱਖਣ ਲਈ ਆਪਣੀ ਕਲਾ ਅੱਗੇ ਜ਼ਰੂਰ ਵੰਡਦਾ ਹੈ ਭਾਵ ਉਹ ਆਪਣੀ ਕਲਾ ਦੀ ਸਿਖਲਾਈ ਆਪਣੇ ਚੇਲੇ ਨੂੰ ਜ਼ਰੂਰ ਦਿੰਦਾ ਹੈ ਇਸ ਤਰ੍ਹਾਂ ਇੱਕ ਕਲਾਕਾਰ ਆਪਣੀ ਕਲਾ ਰਾਹੀਂ ਹਮੇਸ਼ਾ ਅਮਰ ਰਹਿੰਦਾ ਹੈ ਇਸ ਤੋਂ ਇਲਾਵਾ ਭਾਰਤ ਵਿੱਚ ਕਾਲਜਾਂ ਯੂਨੀਵਰਸਿਟੀਆਂ ਵਿੱਚ ਯੂਥ ਫੈਸਟੀਵਲਾਂ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਹਨ ਅਤੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦੇ ਹਨ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਇਸ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਸਿਖਾਇਆ ਹੁੰਦਾ ਹੈ ਉਹਨਾਂ ਕਲਾਕਾਰਾਂ ਦਾ ਵੀ ਨਾਮ ਬਣਦਾ ਹੈ ਅਤੇ ਉਹ ਕਲਾਕਾਰ ਅੱਗੇ ਹੋਰ ਆਪਣੇ ਚੇਲਿਆਂ ਨੂੰ ਸਿਖਾਉਣ ਲਈ ਉਤਸ਼ਾਹਿਤ ਹੁੰਦੇ ਹਨ